ਭਾਰਤ ਦੀ ਰਾਜਨੀਤੀ ਅਤੇ ਸਿਆਸੀ ਪਾਲਟੀ ਬਾਰੇ ਜੇ ਗੱਲ ਕਰੀਏ ਅਤੇ ਸਾਰੇ ਹੀ ਪਾਲਟੀਆਂ ਆਪਣੇ ਕੰਮ ਨੂੰ ਬਹੁਤ ਹੀ ਬਖੂਬੀ ਅਜੰਡੇ ਦੇ ਅਕੋਡਿੰਗ ਨਿਭਾ ਰਹੀਆਂ ਹਨ ਹਰ ਕਿਸੇ ਦਾ ਆਪਣਾ ਇੱਕ ਕੰਮ ਹੈ ਉਹ ਹਰ ਇੱਕ ਪਾਲਟੀ ਆਪਣੇ ਆਪਣੇ ਕੰਮ ਦੇ ਅਕੋਡਿੰਗ ਆਪਣੇ ਆਪਣੇ ਕੰਮ ਕਰ ਰਹੀ ਏ ਜੇ ਗੱਲ ਕਰੀਏ ਲੋਕਤੰਤਰ ਵਜੋਂ ਅਤੇ ਲੋਕਤੰਤਰ ਵਜੋਂ ਜੇ ਅਸੀਂ ਦੇਖਿਆ ਜਾਵੇ ਕਿ ਜਦ ਉੱਨੀ ਸੌ ਸੰਤਾਲੀ ਤੋਂ ਬਾਅਦ ਭਾਰਤ ਦਾ ਜੋ ਸੰਵਿਧਾਨ ਸਾਡੇ ਬਣਾਇਆ ਗਿਆ ਹੈ ਉਹਦੇ ਅਕੋਡਿੰਗ ਉਹਨਾਂ ਨੇ ਭਾਰਤ ਨੂੰ ਭਾਰਤ ਹੀ ਨਹੀਂ ਅਮੀਰ ਗਰੀਬ ਨੂੰ ਹਰ ਇੱਕ ਸਮਾਨਤਾ ਦਿੱਤੀ ਗਈ ਹੈ ਅਤੇ ਇਸਦੇ ਵਿੱਚ ਅਸੀਂ ਦੇਖਿਆ ਜਾਵੇ ਤਾਂ ਕੁਛ ਜਗ੍ਹਾ ਦੇ ਵਿੱਚ ਇਹ ਚੀਜ਼ ਏ ਮ ਮੰਨਿਆਂ ਜਾਂਦਾ ਹੈ ਕਿ ਜਿਸ ਤਰ੍ਹਾਂ ਦੇਖਿਆ ਜਾਵੇ ਕਿ ਇਹ ਇਹ ਲੋਕ ਜੋ ਵੀ ਕੰਮ ਕਰ ਰਹੇ ਨੇ ਉਹਨਾਂ ਵਿੱਚੋਂ ਕੁਛ ਅਜਿਹੇ ਹੁੰਦੇ ਹਨ ਜੋ ਕਿ ਕੰਮ ਬਹੁਤ ਵਧੀਆ ਕਰਦੇ ਹਨ ਅਤੇ ਕੁਝ ਅਜਿਹੇ ਵੀ ਹੁੰਦੇ ਹਨ ਜਿਹੜੇ ਕੰਮ ਨੂੰ ਸਿਰਫ ਟਲਕਾਂਦੇ ਰਹਿੰਦੇ ਨੇ ਜਾਂ ਫਿਰ ਕਿਹਾ ਜਾਵੇ ਕਿ ਉਸ ਕੰਮ ਨੂੰ ਨਾ ਕਰਨ ਦਾ ਇੱਕ ਬਹਾਨਾ ਉਹ ਲੱਭਦੇ ਹਨ ਇਹਦੇ ਵਿੱਚ ਏ ਇਹ ਕੰਮ ਹੋ ਜਾਂਦਾ ਹੈ ਕਿ ਜੇਕਰ ਕੋਈ ਏ ਇਹਨਾਂ ਲੋਕਤੰਤਰ ਇਹਨਾਂ ਕੰਮਾਂ ਨੂੰ ਅਸੀਂ ਰਾ ਰਾਜਨੀਤਿਕ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਇਹ ਕੰਮ ਸਾਡੇ ਲਈ ਪੂ ਬੜੇ ਹੀ ਸਹੀ ਤਰੀਕੇ ਨਾਲ ਕੀਤਾ ਵੀ ਜਾਂਦਾ ਹੈ ਅਤੇ ਕਈ ਚੀਜ਼ ਨੂੰ ਇਗਨੋਰ ਵੀ ਕੀਤਾ ਜਾਂਦਾ ਏ ਜਿਹਨਾਂ ਇਸ ਲੋਕਤੰਤਰ ਦੇ ਵਿੱਚ ਕੁਝ ਚੀਜ਼ਾਂ ਇੱਦਾਂ ਦੀਆਂ ਹੈਗੀਆਂ ਜਿਹੜੀਆਂ ਕਿ ਮੈਨੂੰ ਨਾਪਸੰਦ ਹਨ ਅਤੇ ਜੇ ਮੇਰੇ ਪਸੰਦੀਦਾ ਰਾਜਨੀਤਿਕ ਨੇਤਾ ਦੇ ਤੌਰ 'ਤੇ ਦੇਖਿਆ ਜਾਵੇ ਅਤੇ ਮੇਰੇ ਮੈਂ ਨਰਿੰਦਰ ਮੋਦੀ ਜੀ ਨੂੰ ਬਹੁਤ ਪਸੰਦ ਕਰਦੀ ਹਾਂ ਕਿਉਂਕਿ ਉਹਨਾਂ ਦਾ ਕੰਮ ਕਰਨ ਦਾ ਤ ਤਰੀਕਾ ਉਹਨਾਂ ਦਾ ਢੰਗ ਸਭ ਤੋਂ ਵੱਖਰਾ ਹੈ ਅਤੇ ਇਹ ਮੈਂ ਉਹਨਾਂ ਨੂੰ ਮਿਲ ਕੇ ਇਹੀ ਕਹਿਣਾ ਚਾਹੂੰਗੀ ਕਿ ਸਾਡੇ ਦੇਸ਼ ਨੂੰ ਅਜਿਹਾ ਬਣਾਇਆ ਜਾਵੇ ਤਾਂ ਕਿ ਬਾਹਰਲੇ ਮੁਲਕਾਂ ਦੇ ਨਾਲ ਸਾਡੇ ਮੁਲਕ ਨੂੰ ਪਹਿਲੇ ਨੰਬਰ ਦੇ ਵਿੱਚ ਜਾਣਿਆ ਜਾਵੇ